ਚਿੱਤਰਕਾਰੀ ਲਈ ਮੈਨੂੰ ਵੱਖ ਵੱਖ ਅਕਾਰ ਦੇ ਡਰਾਇੰਗ ਪੇਪਰ ਚਾਹੀਦੇ ਹੁੰਦੇ ਹੈ ਉਹਨੂੰ ਮੈਂ ਮਾਰਕੀਟ ਦੇ ਵਿੱਚ ਜਾ ਕੇ ਲੈ ਕੇ ਆਉਂਦਾ ਏ ਜੇਕਰ ਮੈਨੂੰ ਮਾਰਕੀਟ ਦੇ ਵਿੱਚ ਨਹੀਂ ਮਿਲਦੇ ਤਾਂ ਫਿਰ ਮੈਂ ਨਾਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਨਾਂ ਨੂੰ ਲੈ ਕੇ ਆਉਂਦਾ ਇਸ ਤੋਂ ਇਲਾਵਾ ਡਰਾਇੰਗ ਕਰਨ ਲਈ ਮੈਨੂੰ ਕਲਰ ਚਾਹੀਦੇ ਹੁੰਦੇ ਹੈੈ ਅਤੇ ਵੱਖ ਵੱਖ ਤਰ੍ਹਾਂ ਦੀ ਬਰਸ਼ ਵੀ ਚਾਹੀਦੀ ਹੁੰਦੇ ਹੈ ਜੇਕਰ ਉਹ ਮਾਰਕੀਟ ਵਿੱਚੋਂ ਮਿਲ ਜਾਂਦੇ ਹੈ ਤਾਂ ਸਹੀ ਹੈ ਨਹੀਂ ਤਾਂ ਫਿਰ ਮੈਂ ਉਹਨਾਂ ਨੂੰ ਨੇੜੇ ਦੇ ਜਿਹੜੇ ਜ਼ਿਲ੍ਹੇ ਹੈ ਉਹਨਾਂ ਵਿੱਚ ਜਾ ਕੇ ਵੱਖ ਵੱਖ ਜਿਹੜੀਆਂ ਦੁਕਾਨਾਂ ਜਿਹਨਾਂ ਤੋਂ ਇਹ ਸਮਗਰੀ ਮਿਲਦੀ ਹੈ ਉਹਨਾਂ ਤੋਂ ਲੈ ਕੇ ਆਉਂਦਾ ਇਹੀ ਮੇਰਾ ਜਿਹੜਾ ਢੰਗ ਹੈਗਾ ਜਿਹੜੀ ਮੈਂ ਪੇਂਟਿੰਗ ਲਈ ਜਿਹੜੀ ਆਪਣੀ ਜਿਹੜੀ ਸਮਗਰੀ ਹੈ ਉਹ ਇਕੱਠੀ ਕਰਦਾ ਜਾਂ ਤਾਂ ਮਾਰਕੀਟ ਹੈ ਜੇਕਰ ਮਾਰਕੀਟ 'ਚੋਂ ਨਹੀਂ ਮਿਲਦੀ ਤਾਂ ਮੈਂ ਨੇੜੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਇਸ ਸਮਗਰੀ ਆ ਪੇਂਟਿੰਗ ਦੀ ਪ੍ਰਾਪਤ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ